ਨੌ ਨਵੰਬਰ ਦੋ ਹਜ਼ਾਰ ਪੰਜ ਪੰਜ ਨਵੰਬਰ ਦੋ ਹਜ਼ਾਰ ਛੇ ਛੱਬੀ ਜਨਵਰੀ ਉੱਨੀ ਸੌ ਇਕਾਨਵੇਂ ਪੰਦਰ੍ਹਾਂ ਅਗਸਤ ਉੱਨੀ ਸੌ ਸੰਤਾਲੀ ਦੋ ਜਨਵਰੀ ਦੋ ਹਜ਼ਾਰ ਦੋ